ਮੋਹਾਲੀ ਜ਼ਿਲ੍ਹੇ ਵਿੱਚ ਬਹੁਤ ਸਾਰੇ ਪਿੰਡ ਅਤੇ ਕਸਬੇ ਹਨ ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਖੇਤੀਬਾੜੀ ਵਿੱਚ ਉਹ ਮੁੱਖ ਤੌਰ 'ਤੇ ਫਸਲਾਂ ਉਗਾਉਂਦੇ ਹਨ ਜਿਵੇਂ ਕਿ ਕਣਕ ਚਾਵਲ ਮੱਕੀ ਬਾਜਰਾ ਆਦਿ ਇਸ ਤੋਂ ਇਲਾਵਾ ਉਹ ਉਹ ਪਸ਼ੂ ਪਾਲਣ ਵੀ ਕਰਦੇ ਹਨ ਜਿਸ ਵਿੱਚ ਉਹ ਦੁੱਧ ਤੋਂ ਪੈਸੇ ਕਮਾਉਂਦੇ ਹਨ ਅਤੇ ਨਵੀਂ ਤਕਨਾਲੋਜੀ ਦੀ ਵਰਤੋਂ ਕਰਕੇ ਆਪਣੀ ਖੇਤੀਬਾੜੀ ਨੂੰ ਹੋਰ ਵਧੀਆ ਤਰੀਕੇ ਨਾਲ਼ ਕਰਦੇ ਹਨ ਅੱਜ ਕੱਲ੍ਹ ਤਕਨਾਲੋਜੀ ਦੇ ਨਵੇਂ ਨਵੇਂ ਸਾਧਨਾਂ ਦੇ ਨਾਲ਼ ਖੇਤੀਬਾੜੀ ਨੂੰ ਹੋਰ ਆਸਾਨ ਬਣਾਇਆ ਗਿਆ ਹੈ ਜਿਵੇਂ ਖੇਤਾਂ ਵਿੱਚ ਟਰੈਕਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸਿੰਚਾਈ ਦੇ ਸਾਧਨਾਂ ਲਈ ਟਿਊਵੈੱਲ ਅਤੇ ਹੋਰ ਬਹੁਤ ਸਾਰੇ ਸਾਧਨ ਮੁਹੱਈਆ ਹੋ ਗਏ ਹਨ